ਮੈਂ ਜਸਪ੍ਰੀਤ ਕੌਰ ਪਿੰਡ ਹੰਡਿਆਇਆ ਜ਼ਿਲ੍ਹਾ ਬਰਨਾਲਾ ਦੀ ਪੱਕੀ ਵਕ ਵਸਨੀਕ ਹਾਂ ਸਾਡੇ ਪਿੰਡ ਹੰਡਿਆਇਆ ਵਿੱਚ ਹਰਿਆਲੀ ਨੂੰ ਲੈ ਕੇ ਆਦਮੀ ਬਹੁਤ ਹੀ ਦਿਲਚਸਪੀ ਦਿਖਾ ਰਹੇ ਹਨ ਸਾਡੇ ਪਿੰਡ ਵਿੱਚ ਇੱਕ ਸ਼ਾਮਲਾਟ ਪਿਆ ਹੈ ਜਿੱਥੇ ਕਿ ਅਸੀਂ ਪਿੰਡ ਇਕੱਠੇ ਹੋ ਕੇ ਦਰੱਖਟ ਦਰਖਤ ਲਗਾਉਣ ਵਿੱਚ ਪਹਿਲ ਕਦਮੀ ਕਰਨਾ ਚਾਹੁੰਦੇ ਹਾਂ ਤਾਂ ਕਿ ਵਧੀਆ ਹਾ ਸਾਨੂੰ ਕਿ ਤਾਂ ਕਿ ਸਾਨੂੰ ਵਧੀਆ ਹਰਿਆਲੀ ਅਤ ਪ੍ਰਦਾਨ ਹੋ ਸਕੇ ਅਤੇ ਅਸੀਂ ਵਾਤਾਵਰਨ ਸੁਰਕਸ਼ਿਤ ਰੱਖ ਸਕੀਏ ਅਤੇ ਸਾਨੂੰ ਵਧੀਆ ਕੁੜੇਦਾਨ ਪ੍ਰਦਾਨ ਕੀਤੇ ਜਾਣ ਤਾਂ ਕਿ ਅਸੀਂ ਗਿੱਲਾ ਕੂੜਾ ਅਤੇ ਸੁੱਕਾ ਕੂੜਾ ਇੱਕ ਜਗ੍ਹਾ ਸੁੱਟ ਸਕੀਏ ਇਸ ਨਾਲ ਵੀ ਵਾਤਾਵਰਨ ਵਿੱਚ ਬਹੁਤ ਸੁਧਾਰ ਆਵੇਗਾ ਅਤੇ ਹਰਿਆਲੀ ਵਿੱਚ ਵੀ ਬਹੁਤ ਮਦਦ ਮਿਲੇਗੀ ਹਰਿਆਲੀ ਦੀ ਰਹਿੰਦ ਖੂੰਹਦ ਪੈਦਾ ਕਰਨ ਵਿੱਚ ਸਾਡੀ ਮਦਦ ਕੀਤੀ ਜਾਵੇ ਤਾਂ ਕਿ ਅਸੀਂ ਅੱਗੇ ਵੀ ਆਪਣੇ ਵਾਤਾਵਰਣ ਨੂੰ ਸੁਰਕਸ਼ਿਤ ਰੱਖ ਸਕੀਏ ਸਾਡੇ ਵਾਤਾਵਰਨ ਨੂੰ ਸੁਰਕਸ਼ਿਤ ਰੱਖਣ ਨਾਲ ਸਾਨੂੰ ਵਧੀਆ ਆਕਸੀਜਨ ਪ੍ਰਦਾਨ ਹੋਵੇਗੀ ਅਤੇ ਇਸ ਵਿੱਚ ਹੀ ਅਸੀਂ ਸੁਰਕਸ਼ਿਤ ਰਹਿ ਸਕਦੇ ਹਾਂ ਸਾਡੇ ਪਿੰਡ ਨਿਵਾਸੀ ਅ ਹੰਡਿਆਇਆ ਜ਼ਿਲ੍ਹਾ ਬਰਨਾਲਾ ਦੇ ਰਹਿਣ ਵਾਲੇ ਇਸ ਪਹਿਲਕਦਮੀ ਦੀ ਯੋਜਨਾ ਵਿੱਚ ਬਹੁਤ ਵਧੀਆ ਪਹਿਲ ਨਿਭਾ ਰਹੇ ਹਨ ਤਾਂ ਕਿ ਇਸ ਸਾਨ ਉਹਨਾਂ ਨੂੰ ਸੁਖੀ ਜੀਵਨ ਪ੍ਰਦਾਨ ਹੋ ਸਕੇ ਅਤੇ ਉਹ ਵੀ ਹਰਿਆਲੀ ਦਾ ਮਨੋਰੰਜਨ ਮਾਣ ਸਕਣ ਇਸ ਹਰਿਆਲੀ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਅ ਪਹਿਲਕਦਮੀ ਹੋ ਰਹੀ ਹੈ ਸਾਡੀ ਇਸ ਪਹਿਲਕਦਮੀ ਵਿੱਚ ਵਾਧਾ ਕੀਤਾ ਜਾਵੇ ਤਾਂ ਕਿ ਅਸੀਂ ਵਧੀਆ ਰੁੱਖ ਲਗਾਉਣ ਅਤੇ ਹਰਿਆਲੀ ਦੀ ਰਹਿੰਦ ਖੂੰਹਦ ਨੂੰ ਪੈਦਾ ਕਰਨ ਵਿੱਚ ਕਾਮਯਾਬ ਹੋ ਸਕੀਏ ਸਾਡੀ ਇਸ ਵਿੱਚ ਮਦਦ ਕੀਤੀ ਜਾਵੇ ਮਿਊਸੀਪਲ ਦਫ਼ਤਰ ਨਾਲ ਸੰਪਰਕ ਕੀਤਾ ਜਾਵੇ ਤਾਂ ਕਿ ਅਸੀਂ ਇਹਨਾਂ ਸਾਰੀਆਂ ਸੁਵਿਧਾਵਾਂ ਨੂੰ ਪ੍ਰਦਾਨ ਕਰ ਸਕੀਏ